ਮੇਰਾ ਨਾਮ ਮਨਦੀਪ ਕੌਰ ਹੈ ਅਤੇ ਮੇਰਾ ਜਨਮ ਉੱਨੀ ਜੁਲਾਈ ਉੱਨੀ ਸੌ ਛਿਹੱਤਰ ਬਠਿੰਡੇ ਤੋਂ ਹੈ ਅਤੇ ਮੇਰੀ ਪਹਿਲੀ ਕਲਾਸ ਤੋਂ ਦਸਵੀਂ ਤੱਕ ਦੀ ਪੜ੍ਹਾਈ ਦਸ਼ਮੇਸ਼ ਪਬਲਿਕ ਸੀਨੀਅਰ ਸਕੂਲ ਦੀ ਹੈ ਉਸ ਤੋਂ ਬਾਅਦ ਮੈਂ ਕੋਲਿਜ ਦੀ ਪੜ੍ਹਾਈ ਸਰਕਾਰੀ ਕੋਲਿਜ ਰਜਿੰਦਰਾ ਕੋਲਿਜ ਤੋਂ ਸ਼ੁਰੂ ਕੀਤੀ ਅਤੇ ਉੱਥੋਂ ਆਪਣੀ ਬੀ ਕੋਮ ਕੰਪਲੀਟ ਕੀਤੀ ਪੜ੍ਹਾਈ ਕੰਪਲੀਟ ਕਰਨ ਤੋਂ ਸਾਲ ਬਾਅਦ ਹੀ ਮੇਰੀ ਮੈਰਿਜ ਹੋ ਗਈ ਅਤੇ ਮੇਰੀ ਮੈਰਿਜ ਫਤਿਹਗੜ੍ਹ ਸਾਹਿਬ ਹੋਈ ਅਤੇ ਮੇਰੇ ਹਸਬੈਂਡ ਦਾ ਨਾਮ ਚਰਨਜੀਤ ਸਿੰਘ ਹੈ ਅਤੇ ਉਹ ਇੰਜੀਨੀਅਰਿੰਗ ਕੋਲਿਜ ਬਾਬਾ ਬੰਦਾ ਸਿੰਘ ਬਹਾਦਰ ਫਤਿਹਗੜ੍ਹ ਸਾਹਿਬ ਜੋਬ ਕਰਦੇ ਹਨ ਅਤੇ ਉਸ ਤੋਂ ਵਿਆਹ ਤੋਂ ਸਾਲ ਬਾਅਦ ਸਾਡੇ ਘਰ ਇੱਕ ਬੱਚੇ ਨੇ ਜਨਮ ਲਿਆ ਉਸਦਾ ਨਾਮ ਜਸਪ੍ਰੀਤ ਰੱਖਿਆ ਅਤੇ ਉਸਦੀ ਪੜ੍ਹਾਈ ਪਹਿਲੀ ਤੋਂ ਦਸਵੀਂ ਤੱਕ ਫਤਿਹਗੜ੍ਹ ਸਾਹਿਬ ਦੇ ਸਕੂਲ ਵਿੱਚ ਹੀ ਰਹੀ ਉਸ ਤੋਂ ਬਾਅਦ ਉਸਦੀ ਡੰਮੀ ਐਡਮਿਸ਼ਨ ਕਰਵਾ ਕੇ ਉਸਦੀ ਨਾਨ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਗਈ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਬਾਹਰ ਜਾਣ ਦਾ ਇਰਾਦਾ ਰੱਖਿਆ ਅਤੇ ਉਸ ਨੂੰ ਸਟੱਡੀ ਬੇਸ 'ਤੇ ਬਾਰ੍ਹਵੀਂ ਤੋਂ ਬਾਅਦ ਕਨੇਡਾ ਭੇਜਿਆ ਗਿਆ ਅਤੇ ਉਹ ਹੁਣ ਉੱਥੇ ਬਿਲਕੁਲ ਸੈਟ ਹੈ ਉਸਦੀ ਪੀ ਆਰ ਹੋ ਚੁੱਕੀ ਹੈ